ਮੈਂ ਇੱਕ ਮਲਟੀਨੈਸ਼ਨਲ ਬੈਂਕ ਨਾਲ ਸੰਬੰਧਿਤ ਹਾਂ ਜਿਸ ਵਿੱਚ ਮੈਂ ਸਵਸਥੇ ਬੀਮਾ ਵਿਭਾਗ ਵਿੱਚ ਕੰਮ ਕਰਦਾ ਹਾਂ ਜੇ ਮੈਂ ਸਵਸਥੇ ਬੀਮੇ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੈ ਕੀ ਸਵਸਥੇ ਬੀਮਾ ਅੱਜ ਦੀ ਸਭ ਤੋਂ ਲੋੜਮੰਦ ਚੀਜ਼ ਹੈ ਜੇ ਅਸੀਂ ਪਿਛਲੇ ਪੰਜ ਸਾਲ ਦਾ ਡੇਟਾ ਚੱਕੀਏ ਤਾਂ ਅਸੀਂ ਮੈਂ ਹੋਸਪਿਟਲ ਦੇ ਐਕਸਪੈਂਸਿਸ ਦੀ ਗੱਲ ਕਰੀਏ ਤਾਂ ਹਰ ਸਾਲ ਤੀਹ ਪਰਸੈਂਟ ਉਸ ਵਿੱਚ ਇਜ਼ਾਫਾ ਹੋ ਰਿਹਾ ਹੈ ਅਤੇ ਮੈਂ ਕਈ ਪਰਿਵਾਰ ਇੱਦਾਂ ਦੇ ਦੇਖੇ ਹਨ

ਇਸ ਹੋਸਪਿਟਲ ਦੇ ਐਕਸਪੈਂਸਿਸ ਕਾਰਨ ਉਹਨਾਂ ਦਾ ਸਭ ਕੁਝ ਲੁੱਟ ਜਾਂਦਾ ਹੈ ਅਤੇ ਉਹ ਖਾਲੀ ਹੋ ਜਾਂਦੇ ਹਨ ਇਸ ਨੂੰ ਕਵਰ ਕਰਨ ਲਈ ਹੈਲਥ ਇੰਸ਼ੋਰੈਂਸ ਸਭ ਤੋਂ ਮੇਨ ਟੂਲ ਹੈ ਇਸ ਵਿੱਚ ਅਸੀਂ ਕਿਸੇ ਵੀ ਪਰਿਵਾਰ ਨੂੰ ਪੰਜ ਲੱਖ ਤੋਂ ਲੈ ਕੇ ਦੋ ਕਰੋੜ ਤੱਕ ਦਾ ਬੀਮਾ ਦੇ ਦਿੰਦੇ ਹਨ ਜਿਸ ਨਾਲ਼ ਪਰਿਵਾਰ ਦੀ ਮਦਦ ਹੋ ਜਾਂਦੀ ਹੈ ਕਹਿਣ ਤੋਂ ਭਾਵ ਹੈ ਜੇ ਕੋਈ ਸਵਸਥੇ ਬੀਮਾ ਲੈਂਦਾ ਹੈ ਤਾਂ ਉਸ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਮਤਲਬ ਕਿ ਪੈਸੇ ਵੱਲੋਂ ਹਸਪਿਟਲਾਈਸੇਸ਼ਨ ਦੇ ਖਰਚੇ ਦੀ ਦਿੱਕਤ ਨਹੀਂ ਆਵੇਗੀ ਜੋ ਕਿ ਮੈਨੂੰ ਲੱਗਦਾ ਹੈ ਇੱਕ ਬਹੁਤ ਬੜੀ ਸਪੋਰਟ ਹੈ ਕਿਸੇ ਨੂੰ ਹੱਥ ਅੱਡਣ ਦੀ ਲੋੜ ਨਹੀਂ ਪੈਂਦੀ ਜੇ ਸਵਸਥੇ ਬੀਮਾ ਕਿਸੇ ਪਰਿਵਾਰ ਕੋਲ ਹੋਵੇ ਅਸੀਂ ਇਸ ਵਿੱਚ ਇੰਡੀਵਿਜੁਅਲ ਅਤੇ ਫੈਮਲੀ ਫਲੋਟਰ ਪ੍ਰੋਡਕਟਸ ਦਿੰਦੇ ਹਾਂ ਜਿਹਦੇ ਵਿੱਚ ਪੂਰਾ ਪਰਿਵਾਰ ਅਤੇ ਕੋਈ ਸਿੰਗਲ ਕੋਈ ਵੀ ਕਵਰ ਹੋ ਸਕਦਾ ਹੈ ਇਸ ਵਿੱਚ ਚੌਵੀ ਘੰਟਿਆਂ ਬਾਅਦ ਹੀ ਐਕਸੀਡੈਂਟਲ ਕਵਰ ਸਟਾਰਟ ਹੋ ਜਾਂਦਾ ਹੈ ਅਤੇ ਤੀਹ ਦਿਨ ਬਾਅਦ ਕੋਈ ਨੋਰਮਲ ਹੋਸਪਿਟਲਾਈਜੇਸ਼ਨ ਜਾਂ ਕੋਈ ਕ੍ਰਿਟੀਕਲ ਬਿਮਾਰੀ ਦੀ ਹੋਸਪਿਟਲਾਈਜੇਸ਼ਨ ਕਵਰ ਕਰਨਾ ਸਟਾਟ ਹੋ ਜਾਂਦੀ ਹੈ ਇਸ ਵਿੱਚ ਕੋਈ ਕੈਪਿੰਗ ਨਹੀਂ ਹੁੰਦੀ ਜੇ ਹਸਪਤਾਲ ਦਾ ਬਿੱਲ ਪੰਜ ਲੱਖ ਹੋਵੇ ਤਾਂ ਪੇਸ਼ੈਂਨ ਨੂੰ ਪੂਰਾ ਪੰਜ ਲੱਖ ਮਿਲ ਜਾਂਦਾ ਹੈ